ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਬਲਕਾਰ ਸਬਜ਼ੀ ਵਾਲੇ ਬੋਲਦੇ ਜੀ ਹਾਂਜੀ ਸਬਜ਼ੀ ਕਿਹੜੀ ਕਿਹੜੀ ਰੱਖੀ ਆ ਜੀ ਅੱਛਾ ਜੀ ਭਿੰਡੀ ਭਿੰਡੀ ਕਿਵੇਂ ਆ ਜੀ ਅੱਛਾ ਜੀ ਅੱਛਾ ਜੀ ਔਰਗੈਨਿਕ ਆਪਣੇ ਖੇਤਾਂ 'ਚ ਆਪਣੀ ਲਗਾਈ ਆ ਜੀ ਤੁਸੀਂ ਅੱਛਾ ਜੀ ਅਤੇ ਕੱਦੂ ਕੱਦੂ ਕੀ ਰੇਟ ਹੈ ਜੀ ਅੱਛਾ ਜੀ ਪਿਆਜ਼ ਵੀ ਹੈ ਪਿਆਜ਼ ਕੀ ਰੇਟ ਹੈ ਜੀ ਅੱਛਾ ਜੀ ਚਲੋ ਇੱਦਾਂ ਕਰੋ ਤੁਸੀਂ ਦੁਕਾਨ 'ਤੇ ਹੀ ਹੋ ਮੈਨੂੰ ਆਉਣਾ ਮੈਂ ਥੋੜ੍ਹੇ ਟੈਮ ਤੱਕ ਤੁਸੀਂ ਐਂ ਕਰਿਓ ਕਿੱਲੋ ਭਿੰਡੀ ਕਿੱਲੋ ਕੱਦੂ ਅਤੇ ਪੰਜ ਕਿੱਲੋ ਪਿਆਜ਼ ਅਤੇ ਅੱਧਾ ਕਿੱਲੋ ਟਮਾਟਰ ਤੋਲ ਦਿਓ

ਹਾਂ ਜਿਹੜੀ ਆਪਣੇ ਖੇਤ 'ਚ ਤਿਆਰ ਕੀਤੀ ਆਪਣੇ ਖੇਤ ਜਿਹੜੀ ਲਗਾਈ ਹੋਈ ਤੁਸੀਂ ਉਹ ਕਰਿਓ ਤੇ ਹਾਂ ਮਿਰਚਾਂ ਹੈ ਮਿਰਚਾਂ ਮਿਰਚਾਂ ਧਨੀਆਂ ਵਿੱਚ ਪਾ ਦਿਓ ਨਹੀਂ ਹਰੀਆਂ ਮਿਰਚਾਂ ਅਤੇ ਧਨੀਆਂ ਪਾ ਦਿਓ ਵਿੱਚ ਅਤੇ ਇਹ ਮੈਨੂੰ ਦੱਸ ਦਿਓ ਕੁੱਲ ਕਿੰਨਾ ਬਣ ਗਿਆ ਟੋਟਲ ਚਲੋ ਠੀਕ ਹੈ ਮੈਂ ਤਿੰਨ ਸੌ ਪੈਂਤੀ ਤੁਹਾਨੂੰ ਗੂਗਲ ਪੇਅ ਕਰ ਦਿੰਦਾ ਅਤੇ ਕੋਸ਼ਿਸ਼ ਕਰਿਓ ਤੁਸੀਂ ਮੇਰੇ ਘਰ ਹੀ ਪਹੁੰਚਾ ਦਿਓ ਹਾਂ ਠੀਕ ਆ ਭੇਜ ਦਿਓ ਭੇਜ ਦਿਓ ਗੇਟ 'ਤੇ ਉਹ ਫੜ ਲਏਗਾ ਠੀਕ ਆ ਓਕੇ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਓਕੇ ਜੀ ਓਕੇ